ਹੈਲੋ ਬਰਨਾਲਾ ਕਲੱਬ ਤੋਂ ਬੋਲਦੇ ਜੀ ਹਾਂਜੀ ਮੇਰਾ ਜੀ ਦੋ ਬੇਟਾ ਅਤੇ ਇੱਕ ਬੇਟੀ ਆ ਜੀ ਜੀ ਉਹ ਸਕੂਲ ਜਾਂਦੇ ਨੇ ਸਕੂਲ 'ਚੋਂ ਆ ਕੇ ਜੀ ਮੋਬਾਇਲ ਚੱਕ ਲੈਂਦੇ ਨੇ ਗੇਮ ਗੂਮ ਕੋਈ ਖੇਡਦੇ ਨੀਗੇ ਉਹਨਾਂ ਨੂੰ ਜੀ ਗੇਮ 'ਚ ਪਾਉਣਾ ਚਾਹੁੰਦੇ ਹਾਂ ਜੀ ਕਿਹੜੀਆਂ ਕਿਹੜੀਆਂ ਗੇਮਾਂ ਨੇ ਜੀ ਆਪਣੇ ਕੋਲ ਜੀ ਹਾਂਜੀ

ਅੱਛਾ ਜੀ ਅਤੇ ਜੀ ਆਪਣੀ ਲੋਕੇਸ਼ਨ ਕਿੱਥੇ ਆ ਜੀ

ਹਾਂਜੀ ਆਪਣਾ ਟਾਈਮ ਜੀ ਕਿੰਨੇ ਤੋਂ ਕਿੰਨਾ ਜੀ

ਹਾਂਜੀ ਹਾਂਜੀ ਹਾਂਜੀ ਕਿ ਜਿਵੇਂ ਕਿ ਜੀ ਬੇਟੇ ਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਜੀ ਉਹਨੂੰ ਡਾਂਸ ਸਿਖਾ ਦਿਉ ਹਾਂਜੀ

ਹਾਂਜੀ ਸਵੇਰੇ ਆਵਾਂਗੇ ਓਕੇ ਓਕੇ ਥੈਂਕ ਯੂ ਠੀਕ ਠੀਕ ਥੈਂਕ ਯੂ ਓਕੇ